ਜਿਵੇਂ ਕਿ ਆਪਾਂ ਬਾਈਕਿੰਗ ਕਮਿਊਨਿਟੀ ਦੀ ਦੀ ਗੱਲ ਕਰੀਏ ਬਾਈਕਿੰਗ ਕਮਿਊਨਿਟੀ ਦੇ ਵਿੱਚ ਸਾਈਕਲਿੰਗ ਕਰਨੀ ਬਹੁਤ ਵਧੀਆ ਲੱਗਦਾ ਜਦੋਂ ਗਰੁੱਪ ਦੇ ਵਿੱਚ ਇਕੱਠੇ ਹੋ ਕੇ ਸਵੇਰੇ ਸੈਰ ਕਰਨ ਜਾਂਦੇ ਹਾਂ ਤਾਂ ਬਹੁਤ ਸਾਰੇ ਯਾਰ ਦੋਸਤ ਹੁੰਦੇ ਨੇ ਜਿਹਨਾਂ ਨਾਲ ਮਿਲ ਕੇ ਦਸ ਦਸ ਕਿਲੋਮੀਟਰ ਦੇ ਏਰੀਏ ਦੇ ਵਿੱਚ ਅਸੀਂ ਸਾਈਕਲਿੰਗ ਕਰਦੇ ਹਾਂ ਅਤੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਡਿਸਕਸ ਹੁੰਦੀਆਂ ਨੇ ਜੋ ਬਹੁਤ ਕੁਛ ਸਿੱਖਣ ਨੂੰ ਮਿਲਦਾ ਸਿਹਤ ਸੰਬੰਧੀ ਨੁਕਤੇ ਕੋਈ ਯੋਗਾ ਬਾਰੇ ਦੱਸ ਰਿਹਾ ਹੁੰਦਾ ਕੋਈ ਬਿਮਾਰੀਆਂ ਬਾਹਰੇ ਗੱਲ ਕਰ ਰਿਹਾ ਹੁੰਦਾ ਕੋਈ ਇਨਵਾਇਰਨਾਮੈਂਟ ਨੂੰ ਵਧੀਆ ਬਣਾਉਣ ਵਾਸਤੇ ਗੱਲ ਕਰ ਰਿਹਾ ਹੁੰਦਾ ਤਾਂ ਮੈਨੂੰ ਇਕੱਲੇ ਨੂੰ ਬਾਈਕਿੰਗ ਕਰਨੀ ਬਿਲਕੁਲ ਨਹੀਂ ਚੰਗੀ ਲੱਗਦੀ ਕਿਉਂਕਿ ਇਕੱਲੇ ਨਾਲ ਬੰਦਾ ਬੋਰ ਜਿਹਾ ਹੁੰਦਾ ਰਹਿੰਦਾ ਤਾਂ ਬਾਈਕਿੰਗ ਕਮਿਊਨਿਟੀ ਦੇ ਨਾਲ ਹੀ ਚੰਗਾ ਲੱਗਦਾ ਇਹ ਗੱਲ